ਸਤਿਸੰਗ ਸੱਚਾ ਸੌਦਾ ਵਾਲੇ ਜੋ ਕਿ ਹਰ ਖੇਤਰ ਦੇ ਲੋਕਾਂ ਨੂੰ ਇੱਕ ਸਮਾਨ ਇੱਕ ਨਜ਼ਰੀਆ ਇੱਕ ਅੱਖ ਨਾਲ ਜੋ ਕਿ ਦੇਖਦੇ ਹਨ ਕਿਸੇ ਨਾਲ ਭੇਦਭਾਵ ਕੋਈ ਕਿਸੇ ਕਿਸਮ ਦਾ ਕੋਈ ਵੀ ਹੈ ਇਹ ਸਭ ਇੱਕ ਸਮਾਨ ਰੱਖਦੇ ਹਨ ਜੋ ਕਿ ਜਿਸ ਤਰ੍ਹਾਂ ਕਿ ਬੇਟੀਆਂ ਨੇ ਬੇਟੀਆਂ ਨੂੰ ਲੈ ਕੇ ਪਾਲ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਉਹਨਾਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਨੂੰ ਸਾਰੇ ਇੱਕ ਤਰ੍ਹਾਂ ਦਾ ਪਿਆਰ ਵੀ ਮਿਲਦਾ ਜੋ ਕਿ ਗਰੀਬ ਲੋਕ ਨੇ ਆਪਣੇ ਘਰੇ ਰੋਟੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਲੋਕਾਂ ਲਈ ਰਾਸ਼ਨ ਵ ਵੀ ਦਿੰਦੇ ਹਨ ਜਿਹਨਾਂ ਲੋਕਾਂ ਕੋਲ ਜੇਕਰ ਘਰ ਦਾ ਮਕਾਨ ਨੇ ਕਿਰਾਇਆ ਵੀ ਦੇ ਸਕਦੇ ਉਹਨਾਂ ਲੋਕਾਂ ਨੂੰ ਮਕਾਨ ਵੀ ਬਣਾ ਕੇ ਦਿੰਦੇ ਨੇ ਇਹਨਾਂ ਦੀ ਮਹੱਤਤਾ ਇਹਨਾਂ ਦੀ ਸਹਿਣਸ਼ੀਲਤਾ ਤੋਂ ਦੇਖ ਕੇ ਵੀ ਇਹਨਾਂ ਦੇ ਭਲਾਈ ਦੇ ਕੰਮ ਦੇਖ ਕੇ ਬਹੁਤ ਹੀ ਜਨਤਾ ਇਹ ਕਿ ਇਹਨਾਂ ਦੇ ਹਰੇਕ ਧਰਮ ਦੇ ਲੋਕ ਇਹਨਾਂ ਦੀ ਬਹੁਤ ਹੀ ਪੂਜਾ ਅਤੇ ਪ੍ਰਸ਼ੰਸਾ ਕਰਦੇ ਹਨ ਜੋ ਕਿ ਵੀ ਬੱਚਾ ਕੋਈ ਪੜ੍ਹਾ ਨਹੀਂ ਸਕਦਾ ਇਹ ਉਸ ਬੱਚਿਆਂ ਨੂੰ ਪੜ੍ਹਾਉਂਦੇ ਨੇ ਆਪਦੇ ਚਰਨਾਂ ਦੇ ਨਾਲ ਵੀ ਲਾਉਂਦੇ ਨੇ ਜੋ ਕਿ ਨਸ਼ੇ ਨੇ ਜੋ ਕਰਨ ਨਸ਼ਿਆਂ ਦੇ ਪ੍ਰਭਾਵਿਤ ਹੋ ਜਾਂਦੇ ਨੇ ਉਹਨਾਂ ਨਸ਼ੇ ਛੁਡਾਉਣ ਵਾਸਤੇ ਉਹਨਾਂ ਦੀ ਭਲਾਈ ਕਰਦੇ ਨੇ ਅਤੇ ਜੋ ਕਿ ਬਿਮਾਰ ਹਨ ਉਹਨਾਂ ਨੂੰ ਪੰਜ ਮੈਂਬਰਾਂ ਨੂੰ ਭੇਜ ਕੇ ਜਾਂ ਆਮ ਸੇਵਾਦਾਰ ਪ੍ਰੇਮੀਆਂ ਨੂੰ ਭੇਜ ਕੇ ਉਹਨਾਂ ਦਾ ਇਲਾਜ ਵਾਸਤੇ ਇਲਾਜ ਵੀ ਬਹੁਤ ਸਹਿਣਸ਼ੀਲਤਾ ਨਾਲ ਕਰਵਾਉਂਦੇ ਹਨ ਜੇਕਰ ਕਿਤੇ ਕੋਈ ਸੰਕਟ ਆ ਜਾਂਦਾ ਹੈ ਜਿਵੇਂ ਕਿ ਆਮ ਉੱਥੇ ਪਾਣੀ ਆ ਗਿਆ ਜਾਂ ਕਿਤੇ ਕੋਈ ਸੋਕਾ ਮਾਰ ਗਿਆ ਉਹਨਾਂ ਦਾ ਦੇ ਕੇ ਰਾਸ਼ਨ ਉਹਨਾਂ ਨੂੰ ਉਹਨਾਂ ਦੀ ਮਦਦ ਵੀ ਕਰਦੇ ਨੇ ਅਤੇ ਘਰ ਘਰ ਜਾ ਕੇ ਸਤਿਸੰਗ ਸਿਮਰਨ ਦਾ ਬਲ ਬਖਸ਼ਦੇ ਨੇ ਇਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਧਰਮ ਹਰੇਕ ਕਿਸਮ ਦੇ ਧਰਮ ਦੀ ਮਾਨਤਾ ਕੀਤੀ ਜਾਂਦੀ ਹੈ ਇਹ ਕੋਈ ਮੱਥਾ ਟਿਕਾਈ ਕੋਈ ਕਿਸਮ ਦੇ ਕਿਸੇ ਤਰ੍ਹਾਂ ਦਾ ਕੋਈ ਮੱਥਾ ਟਿਕਾਈ ਹੀ ਨਹੀਂ ਲੈਂਦੇ ਇਹ ਤਾਂ ਸੇਵਾ ਸੰਬੰਧਕ ਜਿਵੇਂ ਸੇਵਾ ਭਲਾਈ ਮਾਨਤਾ ਦੇ ਕੰਮਾਂ ਦੇ ਵਿੱਚ ਲਾ ਕੇ ਬੜੇ ਹੀ ਖੁਸ਼ ਰਹਿੰਦੇ ਨੇ ਜੋ ਕਿ ਸੇਵਾਦਾਰ ਮੈਂਬਰ ਜੋ ਇਹਦੇ ਨਾਲ ਜੁੜੇ ਹੋਏ ਨੇ ਉਹ ਆਮ ਲੋਕਾਂ ਨੂੰ ਵੀ ਉਸੇ ਤਰ੍ਹਾਂ ਹੀ ਸਮਝਦੇ ਨੇ ਪਿਆਰ ਦਿੰਦੇ ਨੇ ਦੁਖੀਆਂ ਦੇ ਕੰਮ ਆਉਂਦੇ ਨੇ ਹਰ ਸੰਕਟ 'ਚ ਕੰਮ ਆਉਂਦੇ ਨੇ ਸਤਿਸੰਗ ਨਾਲ ਜੋੜਦੇ ਨੇ ਨਸ਼ਿਆਂ ਤੋਂ ਛੁਟਕਾਰਾ ਪਾਉਂਦੇ ਨੇ ਜੋ ਕਿ ਇਹਨਾਂ ਦੇ ਚਰਨੀ ਜਾਂ ਸਿਮਰਨ 'ਤੇ ਜੁੜਦਾ ਹੈ ਬੜੇ ਹੀ ਭਾਗਾਂ ਵਾਲਾ ਅਤੇ ਖੁਸ਼ੀਆਂ ਭਰਿਆ ਜੀਵ ਹੈ ਇਹ ਧੰਨ ਧੰਨ ਸਤਿਗੁਰੂ ਦਾ ਨਾਹਰਾ ਲਾ ਕੇ ਹ ਜੋ ਵੀ ਕੰਮ ਕਰਦਿਆਂ ਵੀ ਨਾਹਰਾ ਲਾ ਕੇ ਤੁਹਾਡੇ ਸਭ ਹੀ ਕੰਮ ਪੂਰੇ ਹੋਣਗੇ ਇਹੀ ਫਰਮਾਉਂਦੇ ਨੇ ਇਹ ਮਾਰਗ 'ਤੇ ਚੱਲਣ ਦਾ ਰਸਤਾ ਦਿਖਾਉਂਦੇ ਧੰਨ ਧੰਨ ਸਤਿਗੁਰੂ